ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਤਿੰਨ ਮਾਰਚ ਉੱਨੀ ਸੌ ਬਾਹਠ ਚੌਦ੍ਹਾਂ ਫਰਵਰੀ ਉੱਨੀ ਸੌ ਪੈਂਹਠ ਅੱਠ ਜੂਨ ਉੱਨੀ ਸੌ ਛਿਆਸੀ ਪੰਜ ਸਤੰਬਰ ਉੱਨੀ ਸੌ ਅਠਾਸੀ